ਹੈਲੋ ਮੈਂ ਸਿਮਰਨ ਬੋਲ ਰਹੀ ਤੁਸੀਂ ਉਬਰ ਕੈਬ ਤੋਂ ਗੱਲ ਕਰ ਰਹੇ ਹੋ ਹਾਂਜੀ ਮੈਂ ਇੱਕ ਫਲਾਈਟ ਲੈਣੀ ਹੈ ਰਾਤ ਦੇ ਚਾਰ ਵਜੇ ਕਾਫੀ ਲੇਟ ਨਾਈਟ ਹੈ ਅਤੇ ਮੈਨੂੰ ਤੁਸੀਂ ਪਿੱਕ ਕਰਨਾ ਹੈ ਅਜੀਤ ਨਗਰ ਤੋਂ ਔਰ ਮੇਰੀ ਡੈਸਟੀਨੇਸ਼ਨ ਰਹੇਗੀ ਰਾਜਾ ਸੰਸੀ ਏਅਰਪੋਟ ਅਤੇ ਮੈਂ ਤੁਹਾਨੂੰ ਇਸ ਲਈ ਕੋਲ ਕੀਤੀ ਹੈ ਕਿ ਮੈਂ ਇਕੱਲੀ ਨੇ ਟਰੈਵਲ ਕਰਨਾ ਤੁਸੀਂ ਮੈਨੂੰ ਆਪਣਾ ਕੋਈ ਭਰੋਸੇਮੰਦ ਡਰਾਇਵਰ ਭੇਜਣਾ ਜੋ ਮਤਲਬ ਮੈਨੂੰ ਸੇਫ ਰਹੇ ਅਤੇ ਮੈਂ ਆਪਣਾ ਜਿਹੜਾ ਸਮਾਂ ਮੇਰਾ ਰਹੇਗਾ ਤੁਹਾਡਾ ਜੋ ਆਏਗਾ ਡਰਾਇਵਰ ਮੈਨੂੰ ਸਾਢੇ ਬਾਰਾਂ ਵਜੇ ਅਜੀਤ ਨਗਰ ਤੋਂ ਪਿੱਕ ਕਰੇਗਾ ਅਤੇ ਰਾਜਾ ਸੰਸੀ ਛੱਡੇਗਾ ਏਅਰਪੋਰਟ 'ਤੇ ਉਹਦੇ ਵਿੱਚ ਮੈਨੂੰ ਟਾਇਮ ਜਿੰਨੀ ਛੇਤੀ ਹੋ ਸਕੇ ਓਨੀ ਛੇਤੀ ਪਹੁੰਚਾ ਦਿੱਤਾ ਜਾਵੇ ਕਿਉਂਕਿ ਏਅਰਪੋਰਟ ਦੀਆਂ ਅੱਗੇ ਵੀ ਕਾਫੀ ਵੈਰੀਫਿਕੇਸ਼ਨ ਰਹਿੰਦੀਆਂ ਨੇ ਅਤੇ ਤੁਸੀਂ ਆਪਣਾ ਮੈਨੂੰ ਇੱਕ ਸਥਾਨ ਔਰ ਕੈਬ ਨੰਬਰ ਅਤੇ ਉਸ ਬੰਦੇ ਦਾ ਫੋਨ ਨੰਬਰ ਉਸਦਾ ਪਤਾ ਮੈਨੂੰ ਦੱਸ ਦਿੱਤਾ ਜਾਵੇ